ਮੈਂ ਸਮਾਜ ਨੂੰ ਇਹ ਗੱਲਾਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਲੋਕ ਅੱਜ ਕੱਲ੍ਹ ਲੋਕ ਨੋ ਲੋਕ ਨੌਜਵਾਨ ਬਹੁਤ ਸਾਰੇ ਨਸ਼ਿਆਂ ਨਾਲ ਖਤਮ ਹੋ ਰਹੇ ਹਨ ਬਹੁਤ ਜ਼ਿਆਦਾ ਨਸ਼ਾ ਚੱਲ ਰਿਹਾ ਹੈ ਸਮਾਜ ਵਿੱਚ ਜਿਸ ਕਰਕੇ ਕਈ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਉਹਨਾਂ ਦੇ ਸਰੀਰਾਂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਇਸ ਸੋ ਇਸ ਲਈ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਚੰਗੀ ਦਵਾਈ ਲੈ ਕੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਨਸ਼ਾ ਛੱਡ ਸਕਣ ਅਤੇ ਸਾਨੂੰ ਗਰੀਬ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਲੋਕ ਕਿਸੇ ਵੀ ਗਰੀਬ ਵਿਅਕਤੀ ਵੱਲ ਨਹੀਂ ਵੇਖਦੇ ਸਗੋਂ

ਸਗੋਂ ਉਹਨਾਂ ਨੂੰ ਸਗੋਂ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਅਤੇ ਗਰੀਬ ਵਿਅਕਤੀ ਦੀ ਕੋਈ ਮਦਦ ਨਹੀਂ ਕਰਦੇ ਅਤੇ ਉਹ ਵਿਚਾਰੇ ਭੁੱਖ ਨੰਗ ਨਾਲ ਮਰ ਜਾਂਦੇ ਹਨ ਇਸ ਲਈ ਇਸ ਲਈ ਸਾਨੂੰ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਸਗੋਂ ਜੋ ਆਪਣੀ ਜ਼ਿੰਦਗੀ ਵਧੀਆ ਜੀਅ ਸਕਣ